ਭਾਰਤ ਵਿੱਚ ਅਜਿਹੀਆਂ ਬਹੁਤ ਸਾਰੀਆਂ ਖੇਡਾਂ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਰੂਪ 'ਤੇ ਮਾਨਤਾ ਪ੍ਰਾਪਤ ਹੈ ਪਰ ਅਜਿਹੀਆਂ ਬਹੁਤ ਸਾਰੀਆਂ ਖੇਡਾਂ ਵੀ ਹਨ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਰੂਪ 'ਤੇ ਇੰਨੀ ਜ਼ਿਆਦਾ ਮਾਨਤਾ ਨਹੀਂ ਦਿੱਤੀ ਜਾਂਦੀ ਪਰ ਉਹਨਾਂ ਨੂੰ ਵਧੇਰੇ ਮਾਨਤਾ ਦੀ ਲੋੜ ਹੈ ਮੈਂ ਜ਼ਿਕਰ ਕਰਨ ਜਾ ਰਿਹਾ ਕਬੱਡੀ ਖੇਡ ਦਾ ਜਿਸਨੂੰ ਕਿ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਵੀ ਬਹੁਤ ਜ਼ਿਆਦਾ ਮਾਨਤਾ ਦੀ ਲੋੜ ਹੈ ਕਿਉਂਕਿ ਕਬੱਡੀ ਇੱਕ ਬਹੁਤ ਹੀ ਲੋਕਪ੍ਰਿਅ ਗੇਮ ਹੈ ਜਿਹੜੀ ਕਿ ਅਲੱਗ ਅਲੱਗ ਰਾਜਾਂ ਵਿੱਚ ਅਲੱਗ ਅਲੱਗ ਤਰੀਕੇ ਨਾਲ ਖੇਡੀ ਜਾਂਦੀ ਹੈ ਪਰ ਇਹ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਖੇਡੀ ਜਾਂਦੀ ਆ ਜਿਸਦੇ ਲਈ ਇਸ ਨੂੰ ਬਹੁਤ ਜ਼ਿਆਦਾ ਮਾਨਤਾ ਦੀ ਲੋੜ ਹੈ ਇਹ ਇੱਕ ਪੰਜਾਬ ਦੀ ਬਹੁਤ ਹੀ ਜ਼ਿਆਦਾ ਪ੍ਰਸਿੱਧ ਲੋ ਖੇਡ ਹੈ ਲੋਕ ਖੇਡ ਹੈ ਜਿਹਦੇ ਵਿੱਚ ਬੰਦੇ ਦੀ ਸ਼ਕਤੀ ਬੰਦੇ ਦੀ ਤਾਕਤ ਨੂੰ ਅਜਮਾਇਆ ਜਾਂਦਾ ਹੈ ਅਤੇ ਇਸ ਕਬੱਡੀ ਖੇਡ ਵਿੱਚ ਬੰਦਾ ਬਹੁਤ ਸਾਰੀਆਂ ਚੀਜ਼ਾਂ ਸਿੱਖਦਾ ਹੈ ਜਿਵੇਂ ਕਿ ਕਿਸ ਤਰ੍ਹਾਂ ਤਾਲਮੇਲ ਦੀ ਭਾਵਨਾ ਬਣਾਉਣੀ ਹੈ ਕਿਸ ਤਰ੍ਹਾਂ ਸਾਰਿਆਂ ਨਾਲ ਮਿਲ ਜੁਲ ਕੇ ਰਹਿਣਾ ਆ ਕ ਮੇਰਾ ਤੋ ਇਹ ਹੀ ਕਹਿਣਾ ਕਿ ਜਿਹੜੀ ਕਬੱਡੀ ਖੇਡ ਹੈ ਇਸਨੂੰ ਬਹੁਤ ਹੀ ਜ਼ਿਆਦਾ ਅੰਤਰਰਾਸ਼ਟਰੀ ਪੱਧਰ 'ਤੇ ਵਧੇਰੇ ਮਾਨਤਾ ਦੀ ਲੋੜ ਹੈ ਤਾਂ ਕਿ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਕਬੱਡੀ ਖੇਡ ਬਾਰੇ ਪਤਾ ਲੱਗੇ ਅਤੇ ਇਸ ਦੀ ਬਹੁਤ ਜ਼ਿਆਦਾ ਮਾਨਤਾ ਕੀਤੀ ਜਾਵੇ